ਭਾਰਤ ਵਿੱਚ ਵੱਖ ਵੱਖ ਤਰੀਕਿਆਂ ਦਾ ਮੌਸਮ ਵੇਖਣ ਨੂੰ ਮਿਲਦਾ ਹੈ ਜਿਵੇਂ ਕਿ ਸਰਦੀਆਂ ਦਾ ਮੌਸਮ ਜਨਵਰੀ ਫਰਵਰੀ ਅਤੇ ਦਸੰਬਰ ਦੇ ਮਹੀਨੇ ਵਿੱਚ ਹੁੰਦਾ ਹੈ ਅਤੇ ਜੂਨ ਜੁਲਾਈ ਦੇ ਮਹੀਨੇ ਵਿੱਚ ਗਰਮੀਆਂ ਦਾ ਮੌਸਮ ਵੇਖਣ ਨੂੰ ਮਿਲਦਾ ਹੈ ਗਰਮੀਆਂ ਵਿੱਚ ਇੱਥੇ ਬਹੁਤ ਜ਼ਿਆਦਾ ਧੁੱਪ ਪੈਂਦੀ ਹੈ ਦੇਸ਼ ਦੇ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਤਰੀਕਿਆਂ ਦਾ ਮੌਸਮ ਹੁੰਦਾ ਹੈ ਜਿਵੇਂ ਕਿ ਕੈਨੇਡਾ ਵਿੱਚ ਸਾਨੂੰ ਬਹੁਤ ਜ਼ਿਆਦਾ ਠੰਡ ਵੇਖਣ ਨੂੰ ਮਿਲਦੀ ਹੈ ਅਤੇ ਗਰੀਨਲੈਂਡ ਜਾਂ ਕਿਤੇ ਹੋਰ ਸ਼ਹਿਰਾਂ ਵਿੱਚ ਸਾਨੂੰ ਗਰਮੀ ਦਾ ਮੌਸਮ ਵੇਖਣ ਨੂੰ ਮਿਲਦਾ ਹੈ